ਸਤਿ ਸ਼੍ਰੀ ਅਕਾਲ ਮੈਡਮ ਜੀ ਹਾਂਜੀ ਮੈਡਮ ਜੀ ਅਸੀਂ ਨਾ ਇੱਥੇ ਢੇਸੀਆਂ ਵਿੱਚ ਨਵੇਂ ਨਵੇਂ ਆਏ ਹਾਂ ਦੀਨਾ ਨਗਰ ਤੋਂ ਤੇ ਮਲਕੀ ਪਾਣੀ ਦਾ ਕੀ ਹਿਸਾਬ ਕਿਤਾਬ ਆ ਸਾਨੂੰ ਦੱਸ ਦਓ ਪਾਣੀ ਦਾ ਕਿੰਨੇ ਵਜੇ ਆਉਂਦਾ ਆ ਅਤੇ ਕਿੰਨਾ ਟਾਈਮ ਆਉਂਦਾ ਆ

ਹਾਂ ਠੀਕ ਹੈ ਮੈਡਮ ਜੀ ਧੰਨਵਾਦ